ਜੀ ਹਾਂ ਮੇਰੀ ਨਜ਼ਰ ਵਿੱਚ ਇੱਕ ਕਲਾਕਾਰ ਐਸੇ ਹਨ ਜਿਨ੍ਹਾਂ ਦੀ ਕਲਾਕਾਰੀ ਮੈਨੂੰ ਬਹੁਤ ਹੀ ਪਸੰਦ ਹੈ ਉਹ ਕਲਾਕਾਰ ਮੇਰੀ ਖੁਦ ਦੀ ਭੈਣ ਹੈ ਉਹ ਬਹੁਤ ਹੀ ਵੱਡੇ ਕਲਾਕਾਰ ਨੇ ਅਤੇ ਮੈਨੂੰ ਉਹਨਾਂ ਦੀ ਕਲਾਕਾਰੀ ਬਹੁਤ ਹੀ ਪਸੰਦ ਹੈ ਉਹ ਉਹ ਆਮ ਤੌਰ 'ਤੇ ਚਿੱਤਰਕਾਰੀ ਕਰਦੇ ਹਨ ਅਤੇ ਉਨ੍ਹਾਂ ਦੀ ਚਿੱਤਰਕਾਰੀ ਹੀ ਇੱਕ ਕਲਾ ਹੈ ਚਿੱਤਰਕਾਰੀ ਕਰਨਾ ਇੱਕ ਆਮ ਗੱਲ ਨਹੀਂ ਹੈ ਇਹ ਕੋਈ ਹਰ ਇੱਕ ਇਨਸਾਨ ਨਹੀਂ ਕਰ ਸਕਦਾ ਹੈ ਚਿੱਤਰਕਾਰੀ ਇੱਕ ਬਹੁਤ ਹੀ ਵਧੀਆ ਕਲਾਕਾਰੀ ਹੈ ਅਤੇ ਇਹਦੇ ਵਿੱਚ ਬਹੁਤ ਹੀ ਮਜ਼ਾ ਆਉਂਦਾ ਹੈ ਚਿੱਤਰਕਾਰੀ ਕਰਨਾ ਹਰ ਇੱਕ ਨਹੀਂ ਕਰ ਸਕਦਾ ਅਤੇ ਹਰ ਇੱਕ ਤੋਂ ਹੁੰਦੀ ਵੀ ਨਹੀਂ ਹੈ ਮੈਂ ਇਸ ਕਰਕੇ ਆਪਣੀ ਭੈਣ ਤੋਂ ਪ੍ਰਭਾਵਿਤ ਹੋ ਕੇ ਇਸ ਕਲਾਕਾਰੀ ਵੱਲ ਆਪਣਾ ਧਿਆਨ ਵਟਾਇਆ ਅਤੇ ਇੱਥੇ ਹੀ ਕਲਾਕਾਰੀ ਕਰਨਾ ਸ਼ੁਰੂ ਕੀਤੀ ਇਸ ਕਰਕੇ ਹੀ ਮੈਂ ਅੱਜ ਦੇ ਸਮੇਂ ਵਿੱਚ ਬਹੁਤ ਹੀ ਵਧੀਆ ਕਲਾਕਾਰ ਹਾਂ ਅਤੇ ਮੈਨੂੰ ਇਹ ਪ੍ਰੇਰਨਾ ਮੇਰੀ ਭੈਣ ਦੇ ਦੁਆਰਾ ਹੀ ਮਿਲੀ ਸੀ ਚਿੱਤਰਕਾਰੀ ਕਰਕੇ ਹੀ ਮੈਂ ਅੱਜ ਕਈ ਸਾਰੇ ਪ੍ਰਾਈਜ ਅਤੇ ਮੈਡਲ ਜਿੱਤੇ ਹੋਏ ਨੇ ਜੋ ਕਿ ਮੈਂ ਸਕੂਲ ਲੈਵਲ 'ਤੇ ਵੀ ਜਿੱਤੇ ਸੀ ਅਤੇ ਕਾਲਜ ਲੈਵਲ 'ਤੇ ਵੀ ਜਿੱਤਦੀ ਹਾਂ ਉਹਨਾਂ ਦੀ ਚਿੱਤਰਕਾਰੀ ਮੈਨੂੰ ਇੰਨੀ ਕੁ ਵਧੀਆ ਲੱਗੀ ਸੀ ਕਿ ਮੈਂ ਛੋਟੇ ਹੁੰਦੇ ਤੋਂ ਹੀ ਇਹ ਸਭ ਸ਼ੁਰੂ ਕਰ ਦਿੱਤਾ ਸੀ ਅਤੇ ਉਹ ਅੱਜ ਵੀ ਮੈਨੂੰ ਇਹਨਾਂ ਪ੍ਰਭਾਵਿਤ ਕਰਦੇ ਹਾਂ ਕਿ ਮੈਂ ਜਦੋਂ ਵੀ ਕੋਈ ਵਧੀਆ ਚੀਜ਼ ਦੇਖਦੀ ਹਾਂ ਤਾਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਅਤੇ ਪੂਰੀ ਲਗਨ ਨਾਲ ਬਣਾਉਂਦੀ ਹਾਂ ਅਤੇ ਉਹ ਬਹੁਤ ਹੀ ਵਧੀਆ ਬਣ ਜਾਂਦੀ ਹੈ ਇਸੇਕਰਕੇ ਮੈਂ ਇਸ ਕਲਾਕਾਰ ਇਸ ਕਲਾਕਾਰੀ ਦੀ ਬਹੁਤ ਹੀ ਵੱਡੀ ਫੈਨ ਹਾਂ ਅਤੇ ਇਹੀ ਚੀਜ਼ਾਂ ਮੈਨੂੰ ਆਪਣੀ ਹੋਰ ਕਲਾਕਾਰੀ ਹੋਰ ਕਲਾਕਾਰੀ ਦਿਖਾਉਣ ਲਈ ਪ੍ਰਭਾਵਿਤ ਕਰਦੀਆਂ ਹਨ ਅਤੇ ਸਭ ਤੋਂ ਵੱਡੀ ਪ੍ਰੇਰਨਾ ਮੇਰੀ ਖੁਦ ਦੀ ਭੈਣ ਹੀ ਹੈ